ਹੈਲੋ ਹਾਂਜੀ ਹਾਂਜੀ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਹਾਂਜੀ ਹਾਂਜੀ ਹਾਂਜੀ ਸਾਡੀ ਦੁਕਾਨ 'ਤੇ ਪੰਜਾਬੀ ਸੂਟ ਕੁੜਤੇ ਪਜਾਮੇ ਘੱਗਰੇ ਸਭ ਕੁਛ ਮਿਲ ਜਾਂਦਾ ਹੈ ਜੀ ਹਾਂਜੀ ਹਾਂਜੀ ਸਾਡੇ ਪੰਜਾਬੀ ਸੱਭਿਆਚਾਰ ਦੇ ਰਿਲੇਟਿਡ ਕੋਈ ਵੀ ਆਪਣੇ ਕੱਪੜੇ ਨੇ ਸਾਡੀ ਦੁਕਾਨ 'ਤੇ ਅਵੇਲੇਬਲ ਹੈ ਜੀ ਹਾਂਜੀ ਜੀ ਸਭ ਕੁਛ ਪ੍ਰੋਵਾਈਡ ਮਿਲ ਹੋ ਜੂੰਗਾ ਜੀ ਹਾਂਜੀ ਜੁੱਤੀਆਂ ਵੀ ਰੈਂਟ ਤਾਂ ਜੀ ਜ਼ਿਆਦਾ ਜ਼ਿਆਦਾਤਰ ਸੱਤ ਤੋਂ ਅੱਠ ਹਜ਼ਾਰ ਰੁਪਇਆ ਹੈ ਜੀ ਪਰ ਇੱਕ ਦਿਨ ਦਾ ਨਹੀਂ ਦੋ ਤ ਤਿੰਨ ਦਿਨ ਦਾ ਰੈਂਟ ਲੱਗਦਾ ਹੈ ਕਿਉਂਕਿ ਉਸ ਤੋਂ ਬਾਅਦ ਥੋੜ੍ਹਾ ਧੋ ਧੁਆ ਕੇ ਵੀ ਦੇਣਾ ਪੈਂਦਾ ਹੈ ਜੀ ਹਾਂਜੀ ਸਕਿਉਰਟੀ ਲੈਂਦੇ ਹਾਂ ਜੀ ਜੀ ਸਾਡੀ ਦੁਕਾਨ ਸੁਬਾਹ ਅੱਠ ਤੋਂ ਰਾਤ ਦੇ ਅੱਠ ਵਜੇ ਤੱਕ ਖੁੱਲੀ ਰਹਿੰਦੀ ਹੈ ਜੀ ਤੁਸੀਂ ਕਦੇ ਵੀ ਆ ਸਕਦੇ ਹੋ ਜੀ ਹਾਂਜੀ ਜੀ ਆਇਆ ਨੂੰ ਜੀ